ਹੈਲੋ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਹੈ ਬਸ ਠੀਕ ਹੈ ਕੀ ਕਰਦੇ ਸਾਰੇ ਠੀਕ ਨੇ ਕਾਹਦੀ ਸ਼ੂਟਿੰਗ ਹੈ ਕੋਈ ਨਹੀਂ ਪੁੱਛ ਲੈਣੇ ਘਰ ਫੁੱਫੜ ਤੇਰੇ ਨੂੰ ਪੁੱਛ ਕੇ ਫਿਰ ਚੱਲ ਪਾਂਗੇ ਠੀਕ ਹੈ ਕੋਈ ਨਹੀਂ ਬਾਲੀਵੁੱਡ ਹੈ ਕਿ ਹਾਲੀਵੁੱਡ ਹੈ ਅੱਛਾ ਕਦੋਂ ਜਾਣਾ ਕੌਣ ਕੌਣ ਹੈ ਕੌਣ ਆ ਰਿਹਾ ਉੱਥੇ ਅੱਛਾ ਅਤੇ ਕਿੰਨੇ ਕੁ ਵਜੇ ਜਾਣਾ ਚਲ ਕੋਈ ਨਹੀਂ ਜਾਣ ਨੂੰ ਵੀ ਟਾਈਮ ਲੱਗਣਾ ਫਿਰ ਟਾਈਮ ਨਾਲ ਤਿਆਰ ਹੋ ਜੀ ਠੀਕ ਠੀਕ ਹੈ ਫਿਰ ਕਿੰਨਾ ਕੁ ਟਾਈਮ ਲੱਗਣਾ ਉੱਥੇ ਠੀਕ ਹੈ ਖਾਣ ਪੀਣ ਨੂੰ ਕੀ ਹਿਸਾਬ ਕਿਤਾਬ ਉੱਥੇ ਕੁਝ ਫਿਰ ਘਰ ਬਣਾ ਕੇ ਲੈ ਜੀਏ ਨਹੀਂ ਤਾਂ ਠੀਕ ਹੈ ਅੱਛਾ ਅੱਛਾ ਚੱਲ ਕੋਈ ਨਹੀਂ ਫਿਰ ਵੀ ਆਪਾਂ ਸ਼ਾਮ ਤੱਕ ਆ ਹੀ ਜਾਵਾਂਗੇ ਆਹੋ ਫਿਰ ਘਰ ਆ ਕੇ ਵੀ ਤੈਨੂੰ ਪਤਾ ਕੰਮ ਕੁੰਮ ਕਰਨੇ ਹੁੰਦੇ ਟਾਈਮ ਨਾਲ ਆ ਜਾਂਗੇ ਜਾਣਾ ਕਾਹਦੇ 'ਤੇ ਹੈ ਜਾਣਾ ਕਾਹਦੇ 'ਤੇ ਹੈ ਅੱਛਾ ਕੈਬ 'ਤੇ ਚੱਲਾਂਗੇ ਚੱਲ ਠੀਕ ਹੈ ਕੋਈ ਨਹੀਂ ਫਿਰ ਹਾਂ ਹਾਂ ਹਾਂ ਹਾਂ ਕੋਈ ਗੱਲ ਨਹੀਂ ਆਉਂਦੇ ਨਾ ਅਜੇ ਘਰ ਨਹੀਂ ਗੇ ਆਉਂਦੇ ਆ ਤਾਂ ਫਿਰ ਮੈਂ ਤੈਨੂੰ ਫੋਨ ਕਰ ਦੇਣੀ ਹੈ ਹਾਂ ਹੋਰ ਠੀਕ ਠਾਕ ਸਾਰੇ ਚਲੋ ਠੀਕ ਹੈ ਫਿਰ ਓਕੇ